ਮੈਂ ਪਿਛਲੇ ਕੁਝ ਦਿਨਾਂ ਤੋਂ ਏ ਸੀ ਖਰੀਦਿਆ ਸੀ ਮੈਂ ਮਾਨਸਾ ਸਭ ਤੋਂ ਵਧੀਆ ਦੁਕਾਨ ਅਤੇ ਏ ਸੀ ਲਿਆ ਸੀ ਮੈਨੂੰ ਇਸ ਦੁਕਾਨ ਬਾਰੇ ਸਾਡੇ ਗੁਆਂਢੀਆਂ ਨੇ ਦੱਸਿਆ ਸੀ ਇਹ ਏ ਸੀ ਲੈਣ ਬਾਰੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਅਤੇ ਏ ਸੀ ਬਹੁਤ ਵਧੀਆ ਹੈ ਤੇ ਮੈਨੂੰ ਏ ਸੀ ਤੋਂ ਬਿਨਾਂ ਬਹੁਤ ਪਰੇਸ਼ਾਨੀ ਆ ਰਹੀ ਸੀ ਅਤੇ ਪਰ ਏ ਸੀ ਨਾਲ ਮੈਨੂੰ ਗਰਮੀ ਵਿੱਚ ਕੰਮ ਕਰਨਾ ਸੌਖਾ ਹੋ ਗਿਆ ਸੀ ਅਤੇ ਏ ਸੀ ਨਾਲ ਮੈਨੂੰ ਕਮਰਾ ਦਸ ਮਿੰਟਾਂ ਵਿੱਚ ਠੀਕ ਠੰਡਾ ਹੋ ਜਾਂਦਾ ਹੈ ਏ ਸੀ ਦਾ ਫੈਨ ਵੀ ਚਲਾਉਣ ਨਾਲ ਇਹ ਕਮਰਾ ਜਲਦੀ ਜਲਦੀ ਠੰਡਾ ਹੋ ਜਾਂਦਾ ਹੈ ਕਰ ਦਿੰਦਾ ਹੈ ਅਤੇ ਜਿਸ ਨਾਲ ਜਿਸ ਨਾਲ ਗਰਮੀ ਮਹਿਸੂਸ ਨਹੀਂ ਹੁੰਦੀ ਹੈ ਦੁਕਾਨ ਵਾਲਿਆਂ ਨੇ ਏ ਸੀ ਪੈਸੇ ਤੋਂ ਇਕੱਠੇ ਲੈਣ ਦੇਣ ਦੀ ਲਈ ਨਹੀਂ ਕਿਹਾ ਉਹਨਾਂ ਨੇ ਹਰ ਮਹੀਨੇ ਇੱਕ ਕਿਸ਼ਤ ਬੰਨ ਕੇ ਮੇਰੇ ਨਾਲ ਇਹ ਕੰਮ ਚੰਗਾ ਸੌਖਾ ਕਰ ਦਿੱਤਾ ਹੈ ਅਤੇ ਇਨਵੈਟਰ 'ਤੇ ਏ ਸੀ ਵੀ ਚੱਲ ਦਿੰਦਾ ਹੈ ਅਤੇ ਮੈਨੂੰ ਇਹ ਫ਼ਾਇਦਾ ਹੋਇਆ ਹੈ ਕਿ ਲਾਈਟ ਜਾਣ ਦੇ ਬਾਅਦ ਵੀ ਇਹ ਏ ਸੀ ਚੱਲਦਾ ਰਹਿੰਦਾ ਹੈ ਗਰਮੀ ਮਹਿਸੂਸ ਨਹੀਂ ਹੁੰਦੀ ਇਹ ਮੁਸ਼ਕਿਲ ਨਹੀਂ ਆਉਂਦੀ ਮੈਨੂੰ ਅਤੇ ਸਭ ਤੋਂ ਇਹ ਦੁਕਾਨ ਅਤੇ ਏ ਸੀ ਲੈਣ ਲਈ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਦਾ ਏ ਸੀ ਬਹੁਤ ਵਧੀਆ ਨਿਕਲਿਆ ਹੈ